ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਖੇਡਾਂ ਦੇ ਨਾਲ ਨਾਲ ਕਈ ਲੋਕ ਡਰੱਗ ਵਗੈਰਾ ਦਾ ਇਸਤੇਮਾਲ ਕਰਦੇ ਸਕਦੇ ਹਨ ਸਾਡੇ ਪੂਰੇ ਭਾਰਤ ਵਿੱਚ ਕਈ ਖਿਲਾੜੀ ਐਸੇ ਹਨ ਜਿਹੜੇ ਖੇਲ ਵਿੱਚ ਜਿੱਤਣ ਲਈ ਕਈ ਕੁਝ ਕਰ ਸਕਦੇ ਹਨ ਜਿਵੇਂ ਕਿ ਤੁਸੀਂ ਅੰਦਰ ਕਰਦੇ ਹੋ ਕਿ ਖੇਲ ਨੂੰ ਜਿੱਤਣ ਲਈ ਦੋੜ ਲਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਦੋੜ ਲਾਣ ਦੇ ਨਾਲ ਕਈ ਵਿਅਕਤੀ ਐਸੇ ਵੀ ਹਨ ਜਿਹੜੇ ਦੋੜ ਲਾਣ ਵੇਲੇ ਕੁਛ ਨਸ਼ੀਲੀ ਦ ਪਦਾਰਥਾਂ ਦਾ ਪ੍ਰਯੋਗ ਕਰਦੇ ਹਨ ਜਿਸ ਨਾਲ ਉਹਨਾਂ ਨੂੰ ਤਾਕਤ ਮਿਲਦੀ ਹੈ ਜਿਸ ਕਾਰਨ ਉਹਨਾਂ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਤਾਂ ਉਹ ਗੇਮ ਜਿੱਤਣ ਜਿੱਤ ਸਕਦੇ ਹਨ ਪਰ ਇਹ ਪਰ ਇਹ ਅਸੀਂ ਮੰਨਦੇ ਹਾਂ ਕਿ ਇਹ ਦਵਾਈਆਂ ਸਾਡੀ ਲਈ ਸਰੀਰ ਲਈ ਬਹੁਤ ਹਾਨੀਕਾਰਕ ਹੁੰਦੀਆਂ ਹਨ ਇਹ ਸਾਡੇ ਸਰੀਰ ਨੂੰ ਬਰਬਾਦ ਕਰ ਸਕਦੀਆਂ ਹਨ ਪਰ ਅੱਜ ਕੱਲ੍ਹ ਦੇ ਲੋਕ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਪਰ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨਸ਼ੀਲੀਆਂ ਦਵਾਈਆਂ ਤੋਂ ਅੱਜ ਕੱਲ੍ਹ ਦੇ ਲੋਕ ਦੂਰ ਰਹਿਣੇ ਚਾਹੀਦੇ ਹਨ ਅਸੀਂ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਅੱਜ ਕੱਲ੍ਹ ਜਿਹੜੇ ਲੋਕ ਖੇਡਾਂ ਵਿੱਚ ਨਸ਼ੀਲੀਆਂ ਦਵਾਈਆਂ ਦਾ ਪ੍ਰਯੋਗ ਕਰਦੇ ਹਨ ਉਹਨਾਂ ਦੇ ਘ ਘੱਟ ਤੋਂ ਘੱਟ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਨਸ਼ੀਲੀਆਂ ਦਵਾ ਦਵਾਈਆਂ ਪਦਾਰਥਾਂ ਆਦਿ ਤੋਂ ਦੂਰ ਰੱਖਿਆ ਜਾਵੇ ਅਤੇ ਨ ਨਸ਼ਾ ਛਡਾਓ ਕੈਂਪ ਵੀ ਲਗਾਇਆ ਜਾਂਦਾ ਹੈ ਸਰਕਾਰ ਵੱਲੋਂ ਇਹਨਾਂ ਵਿੱਚ ਦੱਸਿਆ ਜਾਂਦਾ ਹੈ ਕਿ ਸਾਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਕਈ ਕਈ ਜਗ੍ਹਾ 'ਤੇ ਹਰ ਜਗ੍ਹਾ 'ਤੇ ਪੋਸਟਰ ਲਗਾਏ ਜਾਂਦੇ ਹਨ ਨੋ ਡਰੱਗ ਨੋ ਆਦਿ ਆਦਿ ਬਾਰੇ ਦੱਸਿਆ ਜਾਂਦਾ ਹੈ ਸਾਨੂੰ ਕਦੇ ਵੀ ਕਿਤੇ ਕਿਸੇ ਚੀਜ਼ ਨੂੰ ਖੇਡਣ ਲਈ ਕੁਛ ਗਲਤ ਚੀਜ਼ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਜਿਸ ਨਾਲ ਸਾਡੀ ਪੂਰੀ ਜ਼ਿੰਦਗੀ ਬਰਬਾਦ ਹੋ ਜਾਏ ਧੰਨਵਾਦ